ਭੰਗੜੇ ਦੀ ਮਹੱਤਤਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਭੰਗੜਾ ਪੰਜਾਬ ਦਾ ਇੱਕ ਪ੍ਰਚਲਿਤ ਡਾਂਸ ਹੈ ਭੰਗੜੇ ਤੋਂ ਬਿਨਾਂ ਪੰਜਾਬ ਦਾ ਕੋਈ ਵੀ ਫੰਕਸ਼ਨ ਪੂਰਾ ਨਹੀਂ ਹੁੰਦਾ ਮੇਨ ਭੰਗੜਾ ਹੀ ਹਰੇਕ ਪੰਜਾਬ ਦੇ ਫੰਕਸ਼ਨ ਦੇ ਵਿੱਚ ਹੁੰਦਾ ਹੈ ਪਹਿਲਾਂ ਭੰਗੜੇ ਤੋਂ ਹੀ ਸ਼ੁਰੂਆਤ ਹੁੰਦੀ ਹੈ ਅਤੇ ਭੰਗੜੇ ਤੋਂ ਹੀ ਹਰੇਕ ਫੰਕਸ਼ਨ ਖਤਮ ਹੁੰਦਾ ਹੈ ਭੰਗੜੇ ਵੀ ਪੰਜਾਬ ਦੇ ਵਿੱਚ ਬਹੁਤ ਮਹੱਤਤਾ ਹੈ ਪੰਜਾਬ ਦੇ ਗੱਭਰੂ ਅਤੇ ਪੰਜਾਬ ਦੀਆਂ ਮੁਟਿਆਰਾਂ ਵੀ ਅੱਜ ਦੀਆਂ ਗ ਭੰਗੜਾ ਬਹੁਤ ਸੋਹਣਾ ਪਾਉਂਦੀਆਂ ਹਨ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਹੁਣ ਤਾਂ ਭੰਗੜੇ ਦਾ ਫੰਕਸ਼ਨ ਦੇ ਵਿੱਚ ਭੰਗੜਾ ਮੇਨ ਕੀਤਾ ਜਾਂਦਾ ਹੈ ਭੰਗੜੇ ਤਾਂ ਇੱਕ ਬਹੁਤ ਹੀ ਵਧੀਆ ਡਾਂਸ ਹੈ ਭੰਗੜਾ ਦਾ ਡਾਂਸ ਬਿਨਾਂ ਬਾਹਰ ਵੀ ਹੁਣ ਕੋਈ ਫੰਕਸ਼ਨ ਪੂਰਾ ਨਹੀਂ ਹੁੰਦਾ ਫੋਰਨ ਦੇ ਵਿੱਚ ਸਾਡੇ ਪੰਜਾਬੀ ਬਹੁਤ ਜ਼ਿਆਦਾ ਗਏ ਹੋਏ ਹਨ ਉਹ ਹਰੇਕ ਫੰਕਸ਼ਨ ਦੇ ਵਿੱਚ ਭੰਗੜਾ ਮੇਨ ਰੱਖਦੇ ਹਨ ਭੰਗੜੇ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਸਾਡੇ ਪੰਜਾਬ ਦੇ ਗੱਭਰੂ ਨਸ਼ਿਆਂ ਤੋਂ ਦੂਰ ਹੁੰਦੇ ਹਨ ਭੰਗੜੇ ਅਤੇ ਡਾਂਸ ਦੇ ਵਿੱਚ ਜਾ ਕੇ ਆਪਣਾ ਸਰੀਰ ਫਿਟ ਰੱਖਦੇ ਹਨ ਅਤੇ ਪੂਰੇ ਜੋਸ਼ ਹੋਸ਼ ਦੇ ਨਾਲ ਭੰਗੜਾ ਪਾਉਂਦੇ ਹਨ ਅਤੇ ਭੰਗੜੇ ਦੇ ਨਾਲ ਸਾਡਾ ਫੰਕਸ਼ਨ ਨੂੰ ਚਾਰ ਚੰਦ ਲੱਗ ਜਾਂਦੇ ਹਨ ਅਤੇ ਭੰਗੜੇ ਬਿਨਾਂ ਸਾਡਾ ਕੋਈ ਫੰਕਸ਼ਨ ਪੂਰਾ ਹੀ ਨਹੀਂ ਹੁੰਦਾ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਸਾਰੇ ਹੀ ਭੰਗੜਾ ਬਹੁਤ ਵਧੀਆ ਪਾਉਂਦੇ ਹਨ ਅਤੇ ਭੰਗੜੇ ਦੀ ਪੰਜਾਬ ਦੇ ਵਿੱਚ ਤਾਂ ਇੱਕ ਮੇਨ ਰੋਲ ਹੈ ਅਤੇ ਹੁਣ ਦੁਨੀਆਂ ਭਰ ਦੇ ਹਰੇਕ ਸਟੇਟ ਦੇ ਵਿੱਚ ਮਨਾਇਆ ਜਾਂਦਾ ਰਾਜਸਥਾਨ ਹਰਿਆਣਾ ਦੇ ਵਿੱਚ ਵੀ ਭੰਗੜਾ ਮਨਾਇਆ ਜਾਂਦਾ ਹੈ